ਮੈਨੂੰ ਲੱਗਦਾ ਕਿ ਯੋਗਾ ਲਈ ਸਹੀ ਜਗ੍ਹਾ ਚੁਣਨਾ ਬਹੁਤ ਹੀ ਮਹੱਤਵਪੂਰਨ ਹੈ ਜੇ ਮੈਂ ਯੋਗਾ ਕਰਾਂ ਤਾਂ ਮੈਂ ਕਿਸੇ ਸ਼ਾਂਤ ਜਾਂ ਕੁਦਰਤੀ ਜਗ੍ਹਾ ਦੀ ਚੋਣ ਕਰਾਂਗੀ ਮੈਂ ਸ਼ਾਇਦ ਕਿਸੇ ਪਾਰਕ ਵਿੱਚ ਜਾਂ ਕਿਸੇ ਨਦੀ ਦੇ ਕਿਨਾਰੇ ਯੋਗਾ ਕਰਨਾ ਪਸੰਦ ਕਰਾਂਗੀ ਮੈਨੂੰ ਲੱਗਦਾ ਕਿ ਕੁਦਰਤ ਵਿੱਚ ਯੋਗਾ ਕਰਨਾ ਬਹੁਤ ਹੀ ਸ਼ਾਂਤੀਪੂਰਨ ਅਤੇ ਆਰਾਮਦਾਇਕ ਹੁੰਦਾ ਹੈ ਮੈਨੂੰ ਲੱਗਦਾ ਕਿ ਜਗ੍ਹਾ ਦਾ ਮਾਹੌਲ ਯੋਗਾ ਅਤੇ ਅਭਿਆਸ ਨੂੰ ਬਹੁਤ ਪ੍ਰਭਾਵਿਤ ਕਰਦਾ ਜੇ ਤੁਸੀਂ ਸ਼ਾਂਤ ਅਤੇ ਆਰਾਮਦਾਇਕ ਮਾਹੌਲ ਵਿੱਚ ਯੋਗਾ ਕਰਦੇ ਹੋ ਤਾਂ ਤੁਸੀਂ ਆਪਣੇ ਅਭਿਆਸ ਅਤੇ ਮਨ ਵਧੇਰੇ ਕੇਂਦਰਿਤ ਕਰ ਸਕਦੇ ਹੋ ਤੁਸੀਂ ਆਪਣੇ ਸਰੀਰ ਅਤੇ ਮਨ ਨਾਲ ਵਧੇਰੇ ਜੁੜ ਸਕਦੇ ਹੋ ਮੈਨੂੰ ਲੱਗਦਾ ਕਿ ਯੋਗਾ ਲਈ ਸਹੀ ਜਗ੍ਹਾ ਚੁਣਨਾ ਇੱਕ ਨਿੱਜੀ ਚੋਣ ਹੈ ਕੁੱਝ ਲੋਕਾਂ ਨੂੰ ਘਰ ਵਿੱਚ ਯੋਗਾ ਕਰਨਾ ਪਸੰਦ ਹੁੰਦਾ ਹੈ ਜਦੋਂ ਕਿ ਕੁਝ ਲੋਕਾਂ ਨੂੰ ਸਮੂਹ ਵਿੱਚ ਯੋਗਾ ਕਰਨਾ ਪਸੰਦ ਹੁੰਦਾ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਇੱਕ ਅਜਿਹੀ ਜਗ੍ਹਾ ਚੁਣੋ ਜੋ ਤੁਹਾਡੇ ਲਈ ਆਰਾਮਦਾਇਕ ਅਤੇ ਸ਼ਾਂਤੀਪੂਰਨ ਹੋਵੇ ਮੈਨੂੰ ਲੱਗਦਾ ਕਿ ਯੋਗਾ ਇੱਕ ਬਹੁਤ ਹੀ ਵਧੀਆ ਅਭਿਆਸ ਹੋ ਸਕਦਾ ਜੋ ਕਿ ਸਾਡੇ ਸਰੀਰ ਅਤੇ ਮਨ ਦੋਹਾਂ ਲਈ ਫਾਇਦੇਮੰਦ ਹੈ ਜੇ ਤੁਸੀਂ ਯੋਗਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਇਸ ਨੂੰ ਜ਼ਰੂਰ ਆਰਾਮ ਅਜ਼ਮਾਉਣ ਦੀ ਸਲਾਹ ਦਿੰਦੀ ਹਾਂ